ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਹੋਰ ਦੱਸੋ ਸਰ ਤੁਹਾਨੂੰ ਕੀ ਸਮਾਨ ਚਾਹੀਦਾ ਹੈ ਹਾਂਜੀ ਹਾਂਜੀ ਤੁਹਾਨੂੰ ਕੀ ਕੀ ਸਮਾਨ ਚਾਹੀਦਾ ਹੈ ਹਾਂਜੀ ਹਾਂਜੀ ਸਰ ਆ ਵੈਸੇ ਇਹ ਵਾਲਾ ਜਿਹੜਾ ਪ੍ਰੋਜੈਕਟ ਹੈਗਾ ਇਹ ਕਿਸ ਸੰਬੰਧਿਤ ਹੈਗਾ ਬੱਚੇ ਦਾ ਅੱਛਾ ਠੀਕ ਹੈ ਸਰ ਸਾਡੇ ਕੋਲ ਕਾਫ਼ੀ ਸਮਾਨ ਮਿਲ ਜਾਵੇਗਾ ਵੈਸੇ ਤਾਂ ਕਲਰਫੁੱਲ ਪੈੱਨਾਂ ਦੀ ਡੱਬੀ ਵੀ ਮਿਲ ਜਾਵੇਗੀ ਅਤੇ ਇਹ ਡਰਾਇੰਗ ਵਾਲੇ ਪ੍ਰੋਜੈਕਟ ਸਾਰੇ ਜਿਹੜੇ ਕਲਰਫੁੱਲ ਪੇਜ ਹੁੰਦੇ ਨੇ ਉਹ ਵੀ ਮਿਲ ਜਾਣਗੇ ਸਾਡੇ ਕੋਲ ਸਾਰਾ ਸਮਾਨ ਮਿਲਦਾ ਵੈਸੇ ਹੋਰ ਤੁਸੀਂ ਦੱਸ ਦਿਓ ਤੁਹਾਨੂੰ ਕਿਵੇਂ ਚਾਹੀਦੇ ਨੇ ਕਿੰਨੇ ਪੈੱਨ ਚਾਹੀਦੇ ਨੇ ਵੈਸੇ ਕਲਰਫੁੱਲ ਠੀਕ ਹੈ ਹੋਰ ਜਿਹੜੇ ਕਲਰਫੁਲ ਡੱਬੀਆਂ ਸੀਗੀਆਂ ਠੀਕ ਹੈ ਅਤੇ ਸਾਡੇ ਕੋਲ ਸਰ ਉਹ ਡੇਢ ਸੌ ਰੁਪਏ ਦੇ ਨਾ ਪੂਰਾ ਬੰਡਲ ਹੀ ਹੈਗਾ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਰੰਗ ਬਿਰੰਗੇ ਕਾਗਜ਼ ਚਾਹੀਦੇ ਨੇ ਬੱਚੇ ਨੂੰ ਹਾਂਜੀ ਉਹ ਤੁਸੀਂ ਤੁਹਾਨੂੰ ਨਾ ਬੰਡਲ 'ਚ ਹੀ ਲੈਣ ਦਾ ਫ਼ਾਇਦਾ ਹੈਗਾ ਤੁਹਾਨੂੰ ਉਹਦੇ 'ਚ ਵਧੀਆ ਪੈ ਜੂਗੇ ਨਾਲ ਸਸਤੇ ਪੈ ਜਾਂਦੇ ਨੇ ਹਾਂ ਠੀਕ ਹੈ ਸਰ ਸਾਡੇ ਕੋਲ ਨਾ ਹੋਲਸੇਲ ਦਾ ਸਾਰਾ ਸਮਾਨ ਮਿਲ ਜਾਂਦਾ ਬੱਚੇ ਦੇ ਟੀਫਨ ਹੋ ਗਏ ਜਮੈਟਰੀਆਂ ਹੋ ਗਈਆਂ ਯੂਨੀਫੋਮ ਹੋ ਗਈਆਂ ਹੁਣ ਅਸੀਂ ਨਾ ਨਵੇਂ ਬੈਗ ਵੀ ਲੈ ਕੇ ਆਏ ਨੇ ਤੁਸੀਂ ਆਪਣੇ ਜਵਾਕ ਵਾਸਤੇ ਲੈਣਾ ਕੋਈ ਬੈਗ ਹਾਂਜੀ ਅੱਛਾ ਹਾਂਜੀ ਸਾਡੇ ਕੋਲੋਂ ਬਹੁਤ ਸਮਾਨ ਮਿਲ ਜਾਂਦਾ ਸਾਰਾ ਹੀ ਹੋਲਸੇਲ ਰੇਟਾਂ 'ਤੇ ਮਿਲਦਾ ਹੈਗਾ ਜੇ ਤੁਸੀਂ ਜਾਣ ਪਹਿਚਾਣ ਦੇ ਵੀ ਹੋਣ ਨਾ ਉਹਨਾਂ ਨੂੰ ਵੀ ਦੱਸਣਾ ਵੀ ਸਾਡੇ ਦੁਕਾਨ 'ਤੇ ਆਉਣ 'ਤੇ ਸਾਰਾ ਸਮਾਨ ਸਾਡੇ ਹੋਲਸੇਲ 'ਚ ਮਿਲ ਜਾਂਦਾ ਅਤੇ ਸਸਤਾ ਵੀ ਮਿਲ ਜਾਂਦਾ ਨਾਲੇ ਵਿਜੀਟਿੰਗ ਕਾਰਡ ਅਸੀਂ ਤੁਹਾਨੂੰ ਦੇ ਦੇਵਾਂਗੇ ਹਾਂਜੀ

ਜੀ ਠੀਕ ਹੈ ਸਰ ਅਤੇ ਜਿਹੜੇ ਕਲਰਫੁੱਲ ਜਿਹੜੇ ਹੈਗੇ ਆ ਡੱਬੀਆਂ ਇਹ ਤੁਹਾਨੂੰ ਇੱਕ ਪਵੇਗੀ ਵੈਸੇ ਤਾਂ ਪੰਜਾਹ ਦੀ ਮਿਲਦੀ ਹੈ ਬਾਕੀ ਦੁਕਾਨਾਂ 'ਤੇ ਸਾਡੀ ਦੁਕਾਨ 'ਤੇ ਤੁਹਾਨੂੰ ਤੀਹ ਰੁਪਏ ਦੀ ਇੱਕ ਡੱਬੀ ਪੈ ਜਾਵੇਗੀ ਹਾਂਜੀ ਜਿਹੜੇ ਪਾਣੀ ਵਾਲੇ ਕਲਰ ਹੁੰਦੇ ਨੇ ਨਾ ਠੀਕ ਹੈ ਅਤੇ ਤੁਹਾਡੇ ਤਿੰਨ ਸੌ ਰੁਪਏ ਦੇ ਇਸ ਚੀਜ਼ ਦੇ ਹੀ ਹੋ ਗਏ ਠੀਕ ਆ ਅਤੇ ਹੋਰ ਜਿਹੜੇ ਪਲਾਸਟਿਕ ਵਾਲੇ ਜਾਨਵਰਾਂ ਦਾ ਸੈੱਟ ਤੁਹਾਨੂੰ ਪੂਰਾ ਹੀ ਚਾਹੀਦਾ ਹੈ ਖੁੱਲ੍ਹੇ ਮਿਲ ਜਾਂਦੇ ਸਰ ਜਿਵੇਂ ਤੁਸੀਂ ਇੱਕ ਇੱਕ ਕਰਕੇ ਲੈਣਾ ਤਾਂ ਜਿਵੇਂ ਜਿਵੇਂ ਸ਼ੇਰ ਹੁੰਦਾ ਹਾਥੀ ਹੁੰਦਾ ਹੈ ਨਾ ਉਹਦੇ 'ਚ ਨਕਲੀ ਦਰੱਖਤ ਵੀ ਬਣੇ ਹੁੰਦੇ ਨੇ ਅਤੇ ਪਾਣੀ ਪੂਣੀ ਦਾ ਠੀਕ ਹੈ ਸ਼ੇਰ ਹੋ ਗਿਆ ਹਾਥੀ ਹੋ ਗਿਆ ਠੀਕ ਹੈ ਬੱਕਰੀ ਵਗੈਰਾ ਇਹ ਸਾਰੇ ਦੇ ਦਿੰਦੀ ਹਾਂ ਠੀਕ ਹੈ ਪੰਜ ਦੇ ਦਿੰਦੇ ਹਾਂ ਠੀਕ ਹੈ ਪੰਜ ਉਹ ਦੇ ਦਿੰਦੇ ਹਾਂ ਅਤੇ ਤੁਹਾਨੂੰ ਇੱਕ ਇਹ ਕਲਰਫੁਲ ਪੇਪਰਾਂ ਦਾ ਜਿਹੜਾ ਹੈਗਾ ਉਹ ਸੈਟ ਬੰਡਲ ਸੀਗਾ ਨਾ ਪੂਰਾ ਉਹ ਤੁਹਾਨੂੰ ਸਸਤਾ ਪੈ ਜਾਵੇਗਾ ਡੇਢ ਸੌ ਦਾ ਉਹ ਹੋ ਗਿਆ ਅਤੇ ਤਿੰਨ ਸੌ ਦੇ ਤੁਹਾਡੇ ਕਲਰ ਡੱਬੀ ਵਾਲੇ ਹੋ ਗਏ ਠੀਕ ਹੈ ਅਤੇ ਸੌ ਰੁਪਏ ਦਾ ਹੋਰ ਤੁਸੀਂ ਲਾ ਲਓ ਪੈਨ ਦਸ ਚਾਹੀਦੇ ਸੀਗੇ ਨਾ ਅਤੇ ਟੋਟਲ ਤੁਹਾਡੇ ਹੋ ਗਏ ਸਾਢੇ ਪੰਜ ਸੌ ਰੁਪਏ ਹੋ ਗਏ ਕੱਟ ਕਟਾ ਕੇ ਵੈਸੇ ਤਾਂ ਜ਼ਿਆਦਾ ਹੀ ਬਣਦੇ ਸੀ ਤੁਹਾਨੂੰ ਅਸੀਂ ਹੋਲਸੇਲ 'ਚ ਦੇ ਦਿੱਤੇ ਹੋਰ ਸੁਣਾਓ ਸਰ ਕੋਈ ਹੋਰ ਸੇਵਾ ਹੋਵੇ ਹਾਂਜੀ ਜ਼ਰੂਰ ਸਰ ਹਾਂਜੀ ਜ਼ਰੂਰ ਹਾਂਜੀ ਆਪਣੀ ਹੀ ਦੁਕਾਨ ਸਮਝੋ ਤੁਸੀਂ ਜੋ ਤੁਹਾਨੂੰ ਚਾਹੀਦਾ ਹੋਵੇ ਤੁਸੀਂ ਆ ਕੇ ਵੇਖ ਲਿਆ ਕਰੋ ਹਾਂ ਹਾਂਜੀ ਇਹ ਰਾਤ ਨੌ ਵਜੇ ਤਾਈਂ ਸਾਡੀ ਦੁਕਾਨ ਖੁੱਲ੍ਹੀ ਰਹਿੰਦੀ ਸਾਰਾ ਸਮਾਨ ਮਿਲ ਜਾਂਦਾ ਹਾਂਜੀ ਹਾਂਜੀ ਧੰਨਵਾਦ ਸਰ ਜੀ ਹਾਂਜੀ ਠੀਕ